ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਬਹੁਤ ਵੱਡੀ ਮਹੱਤਤਾ ਹੈ ਭੰਗੜਾ ਇੱਕ ਬਹੁਤ ਖੁਸ਼ੀ ਵਾਲਾ ਨਾਚ ਮੰਨਿਆ ਜਾਂਦਾ ਹੈ ਭੰਗੜਾ ਪੰਜਾਬ ਦੇ ਗੱਭਰੂਆਂ ਦਾ ਇੱਕ ਅਣਮੁੱਲਾ ਨਾਚ ਹੈ ਭੰਗੜੇ ਲ ਵਿੱਚ ਗੱਭਰੂਆਂ ਦੇ ਸਰੀਰ ਵਿੱਚ ਫੁਰਤੀ ਆਉਂਦੀ ਹੈ ਅਤੇ ਉਹ ਭੰਗੜੇ ਨਾਲ ਆਪਣੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ ਪੰਜਾਬ ਵਿੱਚ ਭੰਗੜਾ ਕਈ ਤਿਉਹਾਰਾਂ ਉੱਪਰ ਪਾਇਆ ਜਾਂਦਾ ਹੈ ਜਿਵੇਂ ਕਿ ਵਿਸਾਖੀ ਉੱਪਰ ਜਾਂ ਫਿਰ ਦਿਵਾਲੀ ਉੱਪਰ ਹੋਰ ਕਈ ਤਿਉਹਾਰਾਂ ਉੱਪਰ ਭੰਗੜੇ ਨੂੰ ਬਹੁਤ ਖੁਸ਼ੀ ਖੁਸ਼ੀ ਮਨਾਇਆ ਜਾਂਦਾ ਹੈ ਪੰਜ ਪੂਰਾ ਪੰਜਾਬ ਹੀ ਭੰਗੜੇ ਨੂੰ ਦੇਖਣ ਲਈ ਇਕੱਠਾ ਹੁੰਦਾ ਹੈ ਪੂਰੇ ਪੰਜਾਬ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਲੋਕ ਭੰਗੜਾ ਪਾਉਂਦੇ ਹਨ ਅਤੇ ਖੁਸ਼ੀਆਂ ਮਨਾਉਂਦੇ ਹਨ ਇਹ ਬਹੁਤ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਅਤੇ ਅੱਜ ਇਹ ਪੰਜਾਬ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ ਹੈ